ਹਾਂ ਮੇਰੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਫੋਟੋਆਂ ਦੀਆਂ ਹਾਰਡ ਕਾਪੀਆਂ ਪਈਆਂ ਹਨ ਪੁਰਾਣੀਆਂ ਫੋਟੋਆਂ ਬਲੈਕ ਐਂਡ ਵਾਈਟ ਹੁੰਦੀਆਂ ਸਨ ਉਸ ਸਮੇਂ ਲੋਕਾਂ ਦਾ ਪਹਿਰਾਵਾ ਵੀ ਕੁਝ ਅਲੱਗ ਪ੍ਰਕਾਰ ਦਾ ਹੁੰਦਾ ਸੀ ਇਸ ਨਾਲ ਫੋਟੋਆਂ ਵਿਚਲੇ ਬੰਦੇ ਹੋਰ ਵੀ ਭੋਲੇ ਭਾਲੇ ਜਿਹੇ ਲੱਗਦੇ ਸਨ ਪਰੰਤੂ ਅੱਜ ਕੱਲ੍ਹ ਦੇ ਦੌਰ ਵਿੱਚ ਫੋਟੋਆਂ ਖਿੱਚਣਾ ਆਮ ਜਿਹੀ ਗੱਲ ਹੈ ਪਹਿਲਾਂ ਲੋਕ ਕਦੇ ਕਦੇ ਹੀ ਫੋਟੋ ਕਰਵਾਉਂਦੇ ਸਨ ਉਹ ਵੀ ਕੋਈ ਤਿਉਹਾਰ ਜਾਂ ਵਿਆਹ ਸ਼ਾਦੀ ਮੌਕੇ ਇਸ ਲਈ ਉਹਨਾਂ ਨੇ ਫੋਟੋ ਕਰਵਾਉਣ ਦਾ ਬਹੁਤ ਸ਼ੌਕ ਹੁੰਦਾ ਸੀ ਮੇਰੇ ਕੋਲ ਇੱਕ ਫੋਟੋ ਪਈ ਹੈ ਇੱਕ ਪਰਿਵਾਰ ਦੀ ਜੋ ਬਹੁਤ ਖੁਸ਼ ਹੈ ਉਸ ਵਿੱਚ ਅੱਠ ਮੈਂਬਰ ਹਨ ਅਤੇ ਸਾਰੇ ਵਧੀਆ ਖੁਸ਼ ਹਨ ਪਰ ਅਜੋਕੇ ਪਰਿਵਾਰ ਇਸ ਤਰ੍ਹਾਂ ਰਹਿ ਹੀ ਨਹੀਂ ਸਕਦੇ ਜਿਸ ਤਰ੍ਹਾਂ ਅੱਜ ਦੀਆਂ ਫੋਟੋਆਂ ਰੰਗ ਬਿਰੰਗੀਆਂ ਹਨ ਉਸ ਤਰ੍ਹਾਂ ਲੋਕ ਵੀ ਰੰਗ ਬਿਰੰਗੇ ਹੋ ਗਏ ਹਨ ਭਾਵ ਕੋਈ ਕਿਹੋ ਜਿਹੇ ਸੁਭਾਅ ਦਾ ਧਾਰਨੀ ਹੈ ਪਤਾ ਹੀ ਨਹੀਂ ਲੱਗਦਾ